ਮੇਰੀ ਲਿਖਣ ਦੀ ਪ੍ਰਕਿਰਿਆ ਬਹੁਤ ਵਧੀਆ ਰਹੀ ਹੈ ਜਿਵੇਂ ਕਿ ਮੈਂ ਰੂਪ ਰੇਖਾ ਵੀ ਵਧੀਆ ਬਣਾਉਂਦੀ ਪਹਿਲਾਂ ਡਰਾਫਟ ਦੇ ਵਿੱਚ ਲਿਖਦੇ ਹੈਗੇ ਇਸਨੂੰ ਡਰਾਫਟ ਕਰਨ ਵੇਲੇ ਬਹੁਤ ਵਾਰੀ ਪਹਿਲਾਂ ਜਦੋਂ ਤੱਕ ਅੱਖਰ ਹੈਗਾ ਸਹੀ ਲਾਈਨ ਦੇ ਵਿੱਚ ਨਹੀਂ ਲਿਖਿਆ ਜਾਂਦਾ ਤਾਂ ਉਦੋਂ ਤੱਕ ਉਸਨੂੰ ਸੋਚਦੇ ਰਹਿੰਦੇ ਹੈਗੇ ਇਹ ਇਹ ਸਿੱਖਣ ਵੇਲੇ ਮੈਂ ਸਾਡੇ ਸਰ ਸਿਖਾਉਂਦੇ ਹੁੰਦੇ ਸੀਗੇ ਅਸੀਂ ਉਹਨਾਂ ਤੋਂ ਸਿੱਖੇ ਹੈਗੇ ਸਰ ਨੇ ਜਿਵੇਂ ਜਿਵੇਂ ਦੱਸਿਆ ਵੀ ਇੱਦਾਂ ਇਵੇਂ ਲਿਖਣਾ ਇੱਦਾਂ ਇਸ ਰੂਪ ਰੇਖਾ 'ਚ ਲਿਖਣਾ ਹੈਗਾ ਉਸ ਤਰੀਕੇ ਦੇ ਨਾਲ ਅਸੀਂ ਲਿਖ ਦੇਗੇ ਰਹੇ ਆ ਜਿਸ ਦੇ ਨਾਲ ਸਾਡੇ ਜਿਹੜੇ ਲਿਖਾਈ ਹੈ ਲਿਖਣ ਦੀ ਪ੍ਰਕਿਰਿਆ ਹੈਗੀ ਬਹੁਤ ਵਧੀਆ ਤਰੀਕੇ ਨਾਲ ਰਹੀ ਸੀਗੀ ਜਿਸ ਦੇ ਨਾਲ ਪਜੀ ਸਾਡੀ ਪੁਜ਼ੀਸ਼ਨਾਂ ਵੀ ਆਉਂਦੀ ਰਹੀ ਹੈਗੀ ਇਸ ਤਰ੍ਹਾਂ ਅਸੀਂ ਜਿਹੜੀ ਲਿਖਣ ਦੀ ਪ੍ਰਕਿਰਿਆ ਵਧੀਆ ਹੁੰਦੀ ਹੁੰਦੀ ਸੀਗੀ ਅਤੇ ਪਹਿਲਾਂ ਡਰਾਫਟ ਦੇ ਵਿੱਚ ਵੀ ਵਧੀਆ ਲਿਖਦੇ ਹੁੰਦੇ ਸੀਗੇ ਇਸ ਤਰ੍ਹਾਂ ਲਿਖਦੇ ਅਸੀਂ ਸਾਡੇ ਲਿਖਣ ਦੀ ਪ੍ਰਕਿਰਿਆ ਵਧੀਆ ਬਣੀ